ਸਮਾਜ ਵਿੱਚ ਖੇਡਾਂ ਖੇਡਣ ਦਾ ਮਹੱਤਵ ਪੇਂਡੂ ਖੇਡਾਂ ਖੇਡਣ ਦੇ ਮਹੱਤਵ ਬਾਰੇ ਪੇਂਡੂ ਲੋਕਾਂ ਦੀ ਰਾਏ ਇਹ ਹੈ ਕਿ ਇੱਕ ਤਾਂ ਇਸ ਨਾਲ ਜੋ ਨੌਜਵਾਨਾਂ ਦਾ ਉਤਸ਼ਾਹ ਵੱਧਦਾ ਹੈ ਮਾਨਸਿਕ ਤਣਾਅ ਤੋਂ ਠੀਕ ਰਹਿੰਦੇ ਹਨ ਸਰੀਰਕ ਫਿੱਟ ਰਹਿੰਦੇ ਹਨ ਆ ਕੇ ਜਦੋਂ ਪਿੰਡਾਂ ਵਿੱਚ ਖੇਡਾਂ ਕਰਵਾਈਆਂ ਜਾਂਦੀਆਂ ਹਨ ਪਿੰਡ ਦੇ ਸਾਰੇ ਹੀ ਲੋਕ ਉੱਥੇ ਇਕੱਠੇ ਹੁੰਦੇ ਹਨ ਉਹ ਖੇਡਾਂ ਨੂੰ ਵੇਖਣ ਲਈ ਪਿੰਡਾਂ ਦੇ ਲੋਕਾਂ ਦਾ ਇਸ ਨਾਲ ਭਾਈਚਾਰਕ ਭਾਈਚਾਰਾ ਵੱਧਦਾ ਹੈ ਭਾਈਚਾਰਾਂ ਵੱਧਣ ਦੇ ਨਾਲ ਨਾਲ ਪਿੰਡਾਂ ਵਿੱਚੋਂ ਹੀ ਲੋਕ ਘਰ ਘਰ ਵਿੱਚੋਂ ਆਪਣਾ ਚੰਦਾ ਇਕੱਠਾ ਕਰਕੇ ਜਿਹੜਾ ਖਿਡਾਰੀ ਵਧੀਆ ਪ੍ਰਦਰਸ਼ਨ ਕਰਦਾ ਹੈ ਫਿਰ ਉਹਨੂੰ ਮਾਣ ਸਨਮਾਨ ਦਿੱਤਾ ਜਾਂਦਾ ਹੈ ਜਦੋਂ ਉਹਨੂੰ ਮਾਨ ਸਨਮਾਨ ਦਿੱਤਾ ਜਾਂਦਾ ਹੈ ਤਾਂ ਉਸ ਨਾਲ ਆਪਣੇ ਉਹ ਘਰ ਦੀ ਸਥਿਤੀ ਨੂੰ ਠੀਕ ਕਰਦਾ ਹੈ ਜਾਂ ਆਪਣੀ ਖੁਰਾਕ ਵੱਲ ਧਿਆਨ ਦਿੰਦਾ ਹੈ ਇਸ ਕਰਕੇ ਪੇਂਡੂ ਖੇਡਾਂ ਇਹ ਪੇਂਡੂ ਲੋਕਾਂ ਜਿਹੜੇ ਨੇ ਪੇਂਡੂ ਲੋਕਾਂ ਦੀ ਰਾਏ ਬਹੁਤ ਵਧੀਆ ਹੈ ਸਮਾਜ ਵਿੱਚ ਖੇਡਾਂ ਖੇਡਣ ਦੇ ਮਹੱਤਵ ਬਾਰੇ